ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਡਾਂਸ ਹੈ ਪੰਜਾਬ ਦੇ ਹਰ ਫੰਕਸ਼ਨ ਅਤੇ ਤਿਉਹਾਰ ਦੇ ਭੰਗੜਾ ਪਾਇਆ ਜਾਂਦਾ ਹੈ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ ਤੇ ਮੁੰਡਿਆਂ ਲਈ ਕੁੜਤਾ ਚਾਦਰਾ ਜਾਂ ਕੁੜਤਾ ਪਜਾਮਾ ਵੀ ਪਾਇਆ ਜਾਂਦਾ ਹੈ ਕੁੜਤੇ ਚਾਦਰੇ ਉੱਤੇ ਜੈਕਟ ਪਾਈ ਜਾਂਦੀ ਹੈ ਜੋ ਕਿ ਬਹੁਤ ਹੀ ਸੋਹਣੀ ਲੱਗਦੀ ਹੈ ਉਸ ਦੇ ਨਾਲ ਹੀ ਮਾਂਡੀ ਲਾ ਕੇ ਤੁਲੇ ਵਾਲੀ ਪੱਗ ਪਾਈ ਜਾਂਦੀ ਹੈ ਜੋ ਕਿ ਉਸ ਦੀ ਪੋਸ਼ਾਕ ਵਿੱਚ ਚਾਰ ਚੰਦ ਲਗਾ ਦਿੰਦੀ ਹੈ ਅਤੇ ਉਸ ਦੇ ਨਾਲ ਪੈਰਾਂ ਦੇ ਵਿੱਚ ਪੰਜਾਬੀ ਜੁੱਤੀ ਪਾਈ ਜਾਂਦੀ ਹੈ ਅਤੇ ਗਲ ਵਿੱਚ ਕੈਂਠਾ ਅਤੇ ਮੋਤੀਆਂ ਦੀ ਮਾਲਾ ਵੀ ਪਾਈ ਜਾਂਦੀ ਹੈ ਕੁੜੀਆਂ ਲਈ ਭੰਗੜੇ ਦੌਰਾਨ ਪਟਿਆਲਾ ਸਲਵਾਰ ਅਤੇ ਕਮੀਜ ਪਾਈ ਜਾਂਦੀ ਹੈ ਉਸ ਦੇ ਉੱਤੇ ਫੁਲਕਾਰੀ ਜਾਂ ਚੁੰਨੀ ਲਈ ਜਾਂਦੀ ਹੈ ਜੋ ਕਿ ਉਹਨਾਂ ਦੀ ਪੋਸ਼ਾਕ ਨੂੰ ਬਹੁਤ ਹੀ ਸੋਹਣਾ ਬਣਾ ਦਿੰਦੀ ਹੈ ਉਸ ਦੇ ਨਾਲ ਉਹਨਾਂ ਦੀ ਪੈਰਾਂ ਵਿੱਚ ਪੰਜਾਬੀ ਜੁੱਤੀ ਪਾਈ ਜਾਂਦੀ ਹੈ ਭੰਗੜੇ ਦੌਰਾਨ ਭੰਗੜੇ ਦੀ ਪੋਸ਼ਾਕ ਡਾਂਸ ਕਰਨ ਵਾਲਿਆਂ ਨੂੰ ਹੋਰ ਅਕਰਸ਼ਿਤ ਕਰਦੀ ਹੈ ਰੰਗ ਬਰੰਗੇ ਕੁੜਤੇ ਚਾਦਰੇ ਅਤੇ ਉਸਦੇ ਪਾਏ ਗਏ ਤੁਲੇ ਵਾਲੀ ਪੱਗ ਬਹੁਤ ਹੀ ਆਕਰਸ਼ਣ ਕਰਦੀ ਹੈ ਮੁੰਡੇ ਅਤੇ ਕੁੜੀਆਂ ਇਸ ਵਿੱਚ ਗਰੁੱਪ ਬਣਾ ਕੇ ਭੰਗੜਾ ਪਾਉਂਦੇ ਹਨ ਜੋ ਕਿ ਦੇਖਣ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਢੋਲ ਦੀ ਛਾਪ ਉੱਤੇ ਭੰਗੜਾ ਪਾਇਆ ਗਿਆ ਬਹੁਤ ਹੀ ਮਨਮੋਹਕ ਲੱਗਦਾ ਹੈ ਜਿਸ ਦੇ ਵਿੱਚ ਸਮਾਨ ਸਮਾਨ ਕਦਮਾਂ ਤੇ ਪੱਬ ਚੱਕ ਕੇ ਭੰਗੜੇ ਨੂੰ ਬਹੁਤ ਹੀ ਅਕਰਸ਼ਿਤ ਬਣਾ ਦਿੱਤਾ ਜਾਂਦਾ ਹੈ